ਭਾਰਤੀ ਨੌਕਰੀ ਬਾਜ਼ਾਰ ਵਿੱਚ ਬਹੁਤ ਸਾਰੀਆਂ ਨੌਕਰੀਆਂ ਹਨ ਜਿਵੇਂ ਕਿ ਰਿਟੇਲ ਹੈਡ ਇਹ ਕਈ ਸਟੋਰਾਂ ਦੀ ਨਿਗਰਾਨੀ ਕਰਦਾ ਹੈਗਾ ਅਤੇ ਡੈਪੂਟੇਸ਼ਨ ਸੇਲਸ ਐਗ ਐਗਜੀਕੀਕਿਊਟਿਵ ਇਹ ਪ੍ਰਦਰਸ਼ਨੀਆਂ ਕਰਦਾ ਗਾ ਪ੍ਰਚਾਰ ਸੰਬੰਧੀ ਗਤੀਵਿਧੀਆਂ ਕਰਦੇ ਨੇ ਅਤੇ ਨਵੀਤਮਨ ਫੈਸ਼ਨ ਰੁਝਾਨਾਂ ਇਹ ਉਪਕਰਨ ਦੀ ਚੋਣ ਕਰਨ ਵਿੱਚ ਗਾਹਕਾਂ ਦੀ ਸਹਾਇਤਾ ਕਰਦਾ ਗਾ ਸਟੋਰ ਮੈਨੇਜਰ ਇਹ ਪ੍ਰਬੰਧਨ ਕਰਦੇ ਨੇਗੇ ਵਸਤੂ ਸੁੱਚੀ ਤਿਆਰ ਕਰਦੇ ਨੇਗੇ ਰਿਟੇਲ ਐਗਜੀਕਿਊਟਿਵ ਇਹ ਗਾਹਕਾਂ ਦੇ ਸਵ ਸਵਾਲਾਂ ਨੂੰ ਸਾਂਭਦਾ ਐਗਾ ਅਤੇ ਰੋਮਿੰਗ ਸੇਲਜ ਇਹ ਗਾਹਕਾਂ ਦੇ ਨਾਲ ਜੁੜਦਾ ਗਾ ਨਵੀਨ ਰਿਟੇਲ ਫੈਸ਼ਨ ਸਲਾਹਕਾਰ ਇਹ 'ਚ ਉਪਕਰਨਾਂ ਦੀ ਚੋਣ ਚੋਣ ਹੁੰਦੀ ਹੈ ਅਤੇ ਗਾਹਕਾਂ ਦੀ ਸਹਾਇਤਾ ਕਰਦਾ ਹੈ ਅਤੇ ਕੁਝ ਚੁਣੌਤੀਆਂ ਨੇ ਜਿਵੇਂ ਕਿ ਅੱਜ ਕੱਲ੍ਹ ਲੈਵਲ ਬਹੁਤ ਹਾਈ ਹੋ ਗਿਆ ਜਿਸ ਕਰਕੇ ਉਹਨਾਂ ਨੇ ਚ ਚੁਣੌਤੀਆਂ ਦਾ ਬਹੁਤ ਸਾਹਮਣਾ ਕਰਨਾ ਪੈ ਰਿਹਾ ਪੜ੍ਹਾਈ ਵੱਲੋਂ ਅਤੇ ਕਈ ਪੈਸੇ ਕਮਾ ਕਮਾ ਨਹੀਂ ਰਹੇ ਹੈਗੇ ਗੇ ਕਈ ਰੁ ਕਈ ਬੇਰੁਜ਼ਗਾਰ ਹੋ ਰਹੇ ਨੇ ਇਸ ਤਰ੍ਹਾਂ